ਹਾਂਜੀ ਹੈਲੋ ਠੀਕ ਠਾਕ ਤੁਸੀਂ ਸੁਣਾਓ ਠੀਕ ਓਂ

ਅੱਛਾ ਸਕੂਲ ਤਾਂ ਵਧੀਆ ਵੈਸੇ ਆਪਣਾ ਜਿਹੜਾ ਹੈ ਭਤੀਜ ਨ ਅੰਗਦ ਉਹ ਤਾਂ ਇੱਥੇ ਲੱਗਿਆ ਹੋਇਆ ਦਿੱਲੀ ਦੇ ਵਿੱਚ ਦਿੱਲੀ ਪਬਲਿਕ ਸਕੂਲ 'ਚ ਡੀ ਪੀ ਐੱਸ ਉਹ ਵੀ ਠੀਕ ਕਹਿੰਦੇ ਆ ਉਹ 'ਚ ਲਾ ਦਿਉ ਲਾਉਣਾ ਪੜ੍ਹਾਈ ਤਾਂ ਵਧੀਆ ਉੱਥੇ ਪਰ ਕੋਸਟਲੀ ਆ ਉਹ ਖਰਚਾ ਖੁਰਚਾ ਜ਼ਿਆਦਾ ਉੱਥੇ ਹਾਂ

ਹਾਂ

ਹਮ ਵੈਸੇ ਤੁਹਾਡੇ ਵਾਲੇ ਪਾਸੇ ਹੈਗਾ ਤੁਹਾਡੇ ਵਾਲੇ ਪਾਸੇ ਆਹ ਸਕੋਲਰ ਫੀਲਡ ਹੈਗਾ ਗਾ ਹਾਂ ਵਾਈ ਪੀ ਐੱਸ ਉਹ ਵੀ ਵਧੀਆ ਪੂਰਾ ਟੋਪ ਦਾ ਵੀ ਉਹ ਉਹ ਵੀ ਥੋੜ੍ਹਾ ਜਿਹਾ ਕੋਸਟਲੀ ਆ ਜਾਂਦਾ ਵਾਈ ਪੀ ਐੱਸ ਵੀ ਊਂ ਹੈ ਊਂ ਪੜ੍ਹਾਈ ਵਧੀਆ ਜੇ ਕਹੋ ਹਾਂ ਹਾਂ ਹਾਂ ਵੈਸੇ ਵਾਈ ਪੀ ਐੱਸ ਵੀ ਅੱਛਾ ਸਕੋਲਰ ਫੀਲਡ ਅੱਛਾ ਅਤੇ ਬੁੱਢਾ ਦਲ ਵੀ ਨਾਮ ਹੈ ਚੰਗਾ ਬੁੱਢਾ ਦਲ ਦਾ ਉਹ ਵੀ ਲੋਟ ਆ ਨਹੀਂ ਉਹਦੇ 'ਚ ਨਹੀਂ ਹੈ ਅਮਨ ਉਹ ਵੈਸੇ ਅਕਾਲ ਅਕੈਡਮੀ 'ਚ ਹੈ ਇੰਨਸਟ੍ਰਕਸ਼ਨ ਵਗੈਰਾ ਬੁੱਢਾ ਦਲ 'ਚ ਨਹੀਂ ਇੱਦਾਂ ਦਾ ਕੁਛ ਹਾਂ ਅਕਾਲ ਅਕੈਡਮੀ 'ਚ ਹੈ ਹਾਂ ਹਾਂ ਹਾਂ ਹਾਂ ਸਕੋਲਰ ਫੀਲਡ ਇਹਨਾਂ 'ਚ ਤੁਸੀਂ ਦੇਖ ਲਉ ਇਹ ਲੋਟ ਨੇ ਹਮ ਹਮ ਹਾਂ ਬਾਕੀ ਕੋਈ ਗੱਲ ਨਹੀਂ ਜਾ ਕੇ ਇੱਕ ਵਾਰ ਜਾ ਕੇ ਦੇਖ ਕੇ ਆਓ ਤੁਸੀਂ ਫਿਰ ਲੱਗ ਜੂ ਪਤਾ ਡੈਮੋ ਲੈ ਆਓ ਜਾ ਕੇ ਹਮ ਹਮ ਹਮ ਹਮ ਮਿਲ ਜੂਗੀ ਮਿਲ ਜੂ ਬਿਲਕੁਲ ਬਿਲਕੁਲ ਓਕੇ ਮਿਲਦੇ ਹਾਂ ਮੈਂ ਕਰ ਲਾਂ ਕੰਮ ਥੋੜ੍ਹਾ ਜਿਹਾ ਓਕੇ